ਹੈਲੋ ਨਮਸਕਾਰ ਜੀ ਮੈਂ ਤੁਹਾਡੀ ਕੰਪਨੀ ਦਾ ਪਰਫਿਊਮ ਮੰਗਵਾਇਆ ਸੀ ਉਹ ਬਹੁਤ ਪਸੰਦ ਆਇਆ ਮੈਨੂੰ ਬੜਾ ਵਧੀ ਕੁਆ ਵਧੀਆ ਕੁਆਲਿਟੀ ਦਾ ਸੀ ਉਹਦੀ ਖੁਸ਼ਬੂ ਵੀ ਬਹੁਤ ਵਧੀਆ ਸੀ ਮਹਿਕ ਮਹਿਕ ਬਹੁਤ ਵਧ ਵਧੀਆ ਸੀ ਉਹਦੀ ਉਹਦਾ ਕਈਆਂ ਨੂੰ ਪਸੰਦ ਉਹ ਆਇਆ ਯੂਜ ਵੀ ਕੀਤਾ ਕਈਆਂ 'ਤੇ ਉਹਨਾਂ ਨੂੰ ਬਹੁਤ ਪਸੰਦ ਆਇਆ ਹੈਗਾ ਉਹ ਨਾਲ ਪ੍ਰਾਈਜ ਵੀ ਘੱਟ ਹੈਗਾ ਸਸਤਾ ਮਿਲਿਆ ਮੈਨੂੰ ਉਹ ਪ੍ਰ ਪ੍ਰੋਡਕਟ ਤੁਹਾਡਾ ਇਹ ਪਰਫਿਊਮ ਬਹੁਤ ਸਸਤਾ ਸੀਗਾ ਵਾਰ ਵਾਰ ਤੁਹਾਡੀ ਕੰਪਨੀ 'ਚੋਂ ਹੀ ਮੰਗਵਾਵਾਂਗੇ ਅਸੀਂ ਸਾਨੂੰ ਇਹ ਹੈ ਕਿ ਥੋੜ੍ਹੀ ਲੈਸ ਹੋਰ ਮਿਲਜੇ ਜਾਂ ਸਕੀਮ ਦੇ ਦਿਉ ਸਾਨੂੰ ਕੋਈ ਜਿੱਦਾਂ ਕਈ ਕੰਪਨੀਆਂ ਸਕੀਮਾਂ ਦਿੰਦੀਆਂ ਹੈਗੀਆਂ ਦੋਵਾਂ ਨਾਲ ਇੱਕ ਫਰੀ ਐਦਾਂ ਦੀ ਸਕੀਮ ਹੋਰ ਹੋਜੇ ਅਤੇ ਤੁਹਾਡਾ ਜ਼ਿਆਦਾ ਪ੍ਰੋਡਕਟ ਮਤਲਬ ਕਿ ਜ਼ਿਆਦਾ ਚੱਲੇਗਾ ਜ਼ਿਆਦਾ ਵਰਤੋਂ ਹੋਏਗੀ ਉਹਦੀ ਬੜੀ ਅੱਛੀ ਖੁਸ਼ਬੂ ਹੈ ਇਹਦੀ ਬਹੁਤ ਵਧੀਆ ਲੱਗਿਆ ਡਿਲੀਵਰੀ ਟਾਈਮ ਨਾਲ ਆ ਗਈ ਸੀ ਤੁਹਾਡੀ ਅਤੇ ਡਿਲੀਵਰੀ ਟਾਈਮ ਨਾਲ ਦਿੰਦੇ ਰਹੋਗੇ ਅਤੇ ਵਧੀਆ ਰਿਸਪੋਂਸ ਮਿਲੇਗਾ ਤਾਂ ਤੁਹਾਨੂੰ ਫਾਈਵ ਸਟਾਰ ਰੇ ਰੇਟਿੰਗ ਦੇਵਾਂਗੇ ਚੰਗਾ ਫਲੇਮ ਹੈ ਬੜਾ ਸੋਹਣਾ ਪੈਕਿੰਗ ਬਹੁਤ ਵਧੀਆ ਉਹਦੀ ਬੜਾ ਵਧੀਆ ਖੁਸ਼ਬੂ ਹੈ ਹਰ ਚੀਜ਼ 'ਚ ਬੜਾ ਵਧੀਆ ਹੈਗਾ ਆ